ਮੇਰੇ ਲਈ ਇੱਕ ਬਹੁਤ ਹੀ ਮੋਟੀ ਲੇਡੀਜ ਦਾ ਸੂਟ ਆਇਆ ਉਹਦੀ ਸਿਲਾਈ ਮੈਨੂੰ ਬਹੁਤ ਹੀ ਔਖੀ ਰਹੀ ਕਿਉਂਕਿ ਉਹਦੀ ਫਿਟਿੰਗ ਸਹੀ ਨਹੀਂ ਸੀ ਆ ਰਹੀ ਜਿਸ ਕਰਕੇ ਉਸ ਸੂਟ ਨੂੰ ਮੈਂ ਕਈ ਵਾਰ ਉਧੇੜਿਆ ਅਤੇ ਕਈ ਵਾਰ ਸਿਉਂਤਾ ਕਈ ਵਾਰ ਫਿਟਿੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਸੂਟ ਦੀ ਸਵਾਈਂ ਸਿਲਾਈ ਫਿਰ ਵੀ ਫਿਟਿੰਗ ਮੇਰੇ ਤੋਂ ਸਹੀ ਨਹੀਂ ਆਈ ਕਿਉਂਕਿ ਹਰ ਇੱਕ ਵਾਰ ਮੈਂ ਉਸ ਨੂੰ ਫਿਰ ਵੀ ਉਸ ਸੂਟ ਨੂੰ ਕੱਪੜੇ ਨੂੰ ਹੀ ਪਾਸੇ ਕਰਕੇ ਇੱਕ ਹੋਰ ਕੱਪੜਾ ਲਿਆਂਦਾ ਖਰੀਦ ਕੇ ਉਸ ਸੂਟ ਦੇ ਉਸੇ ਨਾਪ ਦਾ ਸੂਟ ਸਿਉਣ ਦੀ ਕੋਸ਼ਿਸ਼ ਕੀਤੀ ਉਸ ਨੂੰ ਹੀ ਉਸ ਤਰੀਕੇ ਵੀ ਮੈਂ ਉਹਨਾਂ ਦੀ ਫਿਟਿੰਗ ਸਹੀ ਕਰ ਸਕਾਂ ਇਸ ਲਈ ਮੈਂ ਉਹਨੂੰ ਫਿਰ ਦੁਬਾਰਾ ਤੋਂ ਨਾਪ ਲੈ ਕੇ ਸਭ ਕੁਝ ਕਰਕੇ ਉਸ ਦੀ ਫੀਟਿੰਗ ਕਰਨ ਦੀ ਆਪਣੇ ਤੋਂ ਕੋਸ਼ਿਸ਼ ਆਪਣੇ ਵੱਲੋਂ ਕੀਤੀ ਪਰ ਫਿਰ ਵੀ ਉਹ ਮੇਰੇ ਕੋਲੋਂ ਸਹੀ ਨਹੀਂ ਹੋਇਆ ਅਤੇ ਕਿਉਂਕਿ ਉਹਦੀ ਫਿਟਿੰਗ ਕਿਉਂਕਿ ਮੋਟੀ ਹੋਣ ਕਰਕੇ ਉਹਨਾਂ ਦੇ ਇਸ ਕਰਕੇ ਮੇਰੇ ਤੋਂ ਉਹਦੀ ਫਿਟਿੰਗ ਸਹੀ ਨਹੀਂ ਆਈ ਫਿਰ ਉਸ ਤੋਂ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਇੱਕ ਰੈਡੀਮੇਡ ਖੁੱਲ੍ਹਾ ਡੁੱਲ੍ਹਾ ਸੂਟ ਲੈ ਕੇ ਅਤੇ ਉਸ ਨੂੰ ਫਿਟਿੰਗ ਕਰਕੇ ਫਿਟਿੰਗ ਉਸ ਦੀ ਠੀਕ ਕਰਕੇ ਦੇਣ ਦੀ ਕੋਸ਼ਿਸ਼ ਕੀਤੀ ਫਿਰ ਵੀ ਉਹਨਾਂ ਦੀ ਫਿਟਿੰਗ ਸਹੀ ਨਾ ਆਈ ਅਤੇ ਦੁਬਾਰਾ ਮੈਨੂੰ ਫਿਰ ਉਸ ਨੂੰ ਸੈਟਿੰਗ ਕਰਨਾ ਪਿਆ ਮੈਂ ਕਿਸੇ ਐਕਸਪਰਟ ਦੀ ਮਦਦ ਦੇ ਨਾਲ ਉਸ ਦੀ ਫਿਟਿੰਗ ਸਹੀ ਕੀਤੀ ਆਪਣੇ ਜਣੇ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਤੇਅ ਉਸ ਨੂੰ ਮੈਂ ਸਹੀ ਕਰਕੇ ਉਹਨਾਂ ਨੂੰ ਦਿੱਤਾ ਫਾਈਨਲੀ ਜਾਨੀ ਕਿ ਮੈਂ ਉਹਦੀ ਫਿਟਿੰਗ ਸਹੀ ਕਰ ਦਿੱਤੀ ਭਾਵਾਂ ਕਿੰਨੀ ਵੀ ਮੈਨੂੰ ਪਰੇਸ਼ਾਨੀ ਆਈ ਕਿੰਨੀ ਵਾਰ ਮੈਨੂੰ ਕੁਛ ਵੀ ਕਰਨਾ ਪਿਆ ਮੈਂ ਸ ਉਹਨੂੰ ਦੀ ਸਹੀ ਫਿਟਿੰਗ ਕਰਕੇ ਉਹਨਾਂ ਨੂੰ ਸੂਟ ਦੇ ਦਿੱਤਾ